ਮੀਡੀਆ ਇੱਕ ਬਹੁਤ ਵਿਕਲਪੀ ਸ਼ਬਦ ਹੈ ਇਸ ਤੋਂ ਭਾਵ ਸੰਚਾਰ ਮਾਧਿਅਮ ਜਿਸ ਵਿੱਚ ਖਬਰਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ ਮੀਡੀਆ ਉਹਨਾਂ ਜਾਣਕਾਰੀਆਂ ਨੂੰ ਸਮਾਜ ਨਾਲ ਸਾਂਝਾ ਕਰਦੀ ਹੈ ਜਿਨਾਂ ਤੱਕ ਹਰ ਕੋਈ ਵਿਅਕਤੀ ਨਹੀਂ ਪਹੁੰਚ ਸਕਦਾ ਮੀਡੀਆ ਸਥਾਨਕ ਅਰਥ ਵਿਵਸਥਾ ਅਤੇ ਭਾਈਚਾਰੇ ਵਿੱਚ ਵੀ ਬਹੁਤ ਯੋਗਦਾਨ ਪਾਂਦੀ ਹੈ ਸਰਕਾਰ ਦੀਆਂ ਨੀਤੀਆਂ ਉਹਨਾਂ ਦੇ ਦੁਆਰਾ ਦਿੱਤੇ ਗਏ ਲਾਭ ਆਮ ਜਨਤਾ ਤੱਕ ਪਹੁੰਚਾਦੀ ਹੈ ਅਤੇ ਸਮਾਜ ਵਿੱਚ ਵਾਪਰ ਰਹੀਆਂ ਚੰਗੀਆਂ ਚੀਜ਼ਾਂ ਵੀ ਆਮ ਜਨਤਾ ਦੇ ਸਾਹਮਣੇ ਲੇ ਕੇ ਆਉਂਦੀ ਹੈ ਜਿਸ ਨਾਲ ਸਮਾਜ ਵਿੱਚ ਸ਼ਾਂਤੀ ਅਤੇ ਪਿਆਰ ਬਣਿਆ ਰਵੇ